ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਸਾਨੂੰ ਓਲਾ ਕੰਪਨੀ ਨੇ ਤੁਹਾਡਾ ਨੰਬਰ ਦਿੱਤਾ ਜੀ ਭਾਅ ਜੀ ਹਾਂਜੀ ਭਾਅ ਜੀ ਮੈਂ ਅਤੇ ਮੇਰੇ ਫਰੈਂਡ ਨੇ ਨਾ ਅਸੀਂ ਚੰਡੀਗੜ੍ਹ ਜਾਣਾ ਹਾਂਜੀ ਦੋ ਜਾਣਿਆਂ ਨੇ ਅਤੇ ਗੱਡੀ ਬੁੱਕ ਕਰਨੀ ਭਾਅ ਜੀ ਹਾਂਜੀ ਹਾਂਜੀ ਭਾਅ ਜੀ ਛੋਟੀ ਗੱਡੀ ਚਾਹੀਦੀ ਆ ਕਿਉਂਕਿ ਅਸੀਂ ਦੋ ਹੀ ਜਾਣੇ ਹੈਗੇ ਹਾਂ ਹਾਂਜੀ ਅਤੇ ਭਾਅ ਜੀ ਕੱਲ੍ਹ ਜਾਣਾ ਜੀ ਅਸੀਂ ਹਾਂਜੀ ਆ ਜੋਗੇ ਸਾਢੇ ਦਸ ਕੁ ਵਜੇ ਤੱਕ ਦਾ ਭਾਅ ਜੀ ਟਾਈਮ ਹੈਗਾ ਜੀ ਜਲਦੀ ਆ ਜਿਓ ਭਾਅ ਜੀ ਹਾਂਜੀ ਤੁਹਾਨੂੰ ਪਤਾ ਵੀ ਹੁਣ ਆਹ ਧੁੰਦ ਦਾ ਥੋੜ੍ਹਾ ਜਿਹਾ ਮੌਸਮ ਹੈਗਾ ਇਸ ਕਰਕੇ ਗੱਡੀ ਵੀ ਥੋੜ੍ਹੀ ਆ ਜਿਹੜੀ ਸਲੋ ਹੀ ਚਲਾਇਓ ਬਾਅਦ 'ਚ ਹੁਣ ਤੁਹਾਨੂੰ ਪਤਾ ਟਰੈਫਿਕ ਟਰੁਫ਼ਿਕ ਹੀ ਹੁੰਦਾ ਵਾ ਹਾਂਜੀ ਟਾਈਮ ਸਿਰ ਪਹੁੰਚਣਾ ਭਾਈ ਅਸੀਂ ਹਾਂਜੀ ਸਾਢੇ ਕੁ ਪੰਜ ਪੰਜ ਕੁ ਵਜੇ ਤੱਕ ਪਹੁੰਚਣਾ ਜੀ ਆ ਜੋਗੇ ਹਾਂਜੀ ਠੀਕ ਆ ਅਤੇ ਭਾਅ ਜੀ ਅਡਰੈਸ ਨੋਟ ਕਰ ਲਉ ਸਾਡੇ ਘਰ ਦਾ ਹਾਂਜੀ ਉੱਨੀ ਏ ਘਣੂਪੁਰ ਨੀਅਰ ਭਾਈ ਲਾਲੀ ਦੀ ਹਵੇਲੀ ਦੋ ਹੀ ਜਾਣੇ ਹੈਗੇ ਭਾਅ ਜੀ ਹਾਂਜੀ ਅਤੇ ਮ ਪੈਸੇ ਦੱਸ ਦਿਉ ਭਾਅ ਜੀ ਕਿੰਨੇ ਕੁ ਲੈਣੇ ਜੇ ਕਿੰਨੇ ਪੰਦਰਾਂ ਸੌ ਇਹ ਭਾਅ ਜੀ ਜ਼ਿਆਦਾ ਹੈਗੇ ਥੋੜ੍ਹੇ ਘੱਟ ਕਰ ਲਿਓ ਤੇਰ੍ਹਾਂ ਸੌ ਸਹੀ ਹੈਗਾ ਭਾਅ ਜੀ ਹਾਂਜੀ ਕੱਲ੍ਹ ਆ ਜਿਓ ਭਾਅ ਜੀ ਠੀਕ ਹੈ